ਹਾਂਜੀ ਬਹੁਤ ਸਾਰੀਆਂ ਬਾਹਰੀ ਗਤੀਵਿਧੀਆਂ ਹਨ ਜਿਹਨਾਂ ਵਿੱਚ ਮੈਨੂੰ ਭਾਗ ਲੈਣਾ ਪਸੰਦ ਹੈ ਕਿਉਂਕਿ ਇਹਨਾਂ ਦੇ ਨਾਲ਼ ਸਾਡਾ ਸਰੀਰ ਰਿਸ਼ਟ ਪੁਸ਼ਟ ਰਹਿੰਦਾ ਹੈ ਅਤੇ ਅਸੀਂ ਤੰਦਰੁਸਤੀ ਨੂੰ ਆਪਣੇ ਜੀਵਨ ਵਿੱਚ ਲੈ ਕੇ ਆ ਸਕਦੇ ਹਾਂ ਮੈਂ ਜ਼ਿਆਦਾਤਰ ਸੈਰ ਕਰਨ ਵਿੱਚ ਵਿਸ਼ਵਾਸ ਰੱਖਦਾ ਹਾਂ ਅਤੇ ਕਈ ਵਾਰ ਮੈਂ ਦੌੜ ਵੀ ਲੈਂਦਾ ਹਾਂ ਦੌੜਨ ਦੇ ਨਾਲ਼ ਮੇਰਾ ਸਰੀਰ ਮਜ਼ਬੂਤ ਬਣਿਆ ਰਹਿੰਦਾ ਹੈ ਅਤੇ ਸਾਰੇ ਮਾਸ਼ਪੇਸ਼ੀਆਂ ਚੰਗੀ ਤਰੀਕੇ ਨਾਲ਼ ਕੰਮ ਕਰਦੀਆਂ ਹਨ ਦਿਮਾਗ ਵੀ ਵਧੀਆ ਤਰੀਕੇ ਨਾਲ਼ ਕੰਮ ਕਰਨ ਲੱਗਦਾ ਹੈ ਇਸ ਤੋਂ ਇਲਾਵਾ ਮੈਂ ਕਈ ਖੇਡਾਂ ਵੀ ਖੇਡ ਲੈਂਦਾ ਹਾਂ ਜਿਵੇਂ ਕਿ ਕ੍ਰਿਕਟ ਹੋ ਗਈ ਵਾਲੀਵਾਲ ਹੋ ਗਈ ਫੁੱਟਵੋਲ ਹੋ ਗਈ ਇਹ ਖੇਡਾਂ ਮੈਂ ਅਕਸਰ ਹੀ ਖੇਡਦਾ ਰਹਿੰਦਾ ਹਾਂ ਇਸ ਤੋਂ ਇਲਾਵਾ ਕਈ ਵਾਰ ਜਦ ਪਹਾੜਾਂ ਵੱਲ ਫੇਰੀ ਪੈਂਦੀ ਹੈ ਤਾਂ ਮੈਂ ਟ੍ਰੈਕਿੰਗ ਵੀ ਕਰਦਾ ਰਹਿੰਦਾ ਹਾਂ ਟ੍ਰੈਕਿੰਗ ਕਰਨ ਦੇ ਨਾਲ਼ ਮੈਨੂੰ ਬਹੁਤ ਚਾਅ ਚੜ੍ਹ ਜਾਂਦਾ ਹੈ ਇਹ ਮੇਰਾ ਸਭ ਤੋਂ ਪਸੰਦੀਦਾ ਗਤੀਵਿਧੀ ਹੈ ਅਤੇ ਟ੍ਰੈਕਿੰਗ ਦੇ ਦੌਰਾਨ ਹੀ ਸਾਡੇ ਸਾਡੇ ਨਾਲ਼ ਬਾਹਰ ਤੋਂ ਕਈ ਲੋਕ ਵੀ ਅਜਿਹੇ ਮਿਲਦੇ ਹਨ ਜੋ ਟ੍ਰੈਕਿੰਗ ਕਰ ਰਹੇ ਹੁੰਦੇ ਹਨ ਇਹਨਾਂ ਦੇ ਨਾਲ਼ ਹੀ ਸਾਡਾ ਹੋਰਨਾਂ ਲੋਕਾਂ ਨਾਲ਼ ਵੀ ਸੰਬੰਧ ਵਧੀਆ ਬਣਦਾ ਹੈ